ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰੁਣ ਕੁਮਾਰ ਹੈ ਮੈਂ ਗੁਰਦਾਸਪੁਰ ਜਿਲ੍ਹੇ ਵਿੱਚ ਰਹਿੰਦਾ ਹਾਂ ਮੇਰੇ ਪਿੰਡ ਦਾ ਨਾਮ ਘਰਾਲਾ ਹੈ ਪਿੰਡਾਂ ਦੇ ਵਿੱਚ ਅਲੱਗ ਅਲੱਗ ਬਿਮਾਰੀਆਂ ਲਈ ਬਹੁਤ ਸਾਰੇ ਨੁਸਖੇ ਪ੍ਰਸਿੱਧ ਹੁੰਦੇ ਹਨ ਜਿਵੇਂ ਕਿ ਕਬਜ਼ ਦੀ ਬਿਮਾਰੀ ਲਈ ਵੀ ਬਹੁਤ ਸਾਰੇ ਨੁਸਖੇ ਪ੍ਰਸਿੱਧ ਹਨ ਇਹ ਨੁਸਖੇ ਸਾਨੂੰ ਸਾਡੇ ਬਜ਼ੁਰਗਾਂ ਤੋਂ ਪਤਾ ਚੱਲਦੇ ਹਨ ਕਬਜ਼ ਦੀ ਬਿਮਾਰੀ ਲਈ ਘਰੇਲੂ ਨੁਸਖੇ ਮੈਨੂੰ ਵੀ ਮੇਰੀ ਦਾਦੀ ਜੀ ਤੋਂ ਪਤਾ ਚੱਲੇ ਹਨ ਇਹਨਾਂ ਵਿੱਚ ਕੁਝ ਨੁਸਖੇ ਇਸ ਤਰ੍ਹਾਂ ਹਨ ਜਿਵੇਂ ਕਿ ਸਵੇਰੇ ਉੱਠ ਕੇ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਹੈ ਪਾਣੀ ਨੂੰ ਕੋਸਾ ਕਰਕੇ ਥੋੜ੍ਹਾ ਥੋੜ੍ਹਾ ਪੀਣਾ ਚਾਹੀਦਾ ਹੈ ਦੂਜੇ ਨੁਸਖੇ ਦੀ ਗੱਲ ਕਰੀਏ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਦੇ ਵਿੱਚ ਸੋਗੀ ਨੂੰ ਭਿਓ ਦੇਣਾ ਚਾਹੀਦਾ ਹੈ ਸਵੇਰ ਤੱਕ ਸੋਗੀ ਆਪਣਾ ਅਸਰ ਪਾਣੀ ਵਿੱਚ ਛੱਡ ਦਿੰਦੀ ਹੈ ਸਵੇਰੇ ਉੱਠ ਕੇ ਉਸ ਪਾਣੀ ਨੂੰ ਪੀ ਲੈਣਾ ਚਾਹੀਦਾ ਹੈ ਇਸ ਦੇ ਨਾਲ ਕਬਜ਼ ਦੇ ਵਿੱਚ ਰਾਹਤ ਮਿਲਦੀ ਹੈ ਤੀਜੇ ਨੁਸਖੇ ਦੀ ਗੱਲ ਕਰੀਏ ਤਾਂ ਇਸ ਵਿੱਚ ਅਰਹੰਡ ਦੇ ਤੇਲ ਨੂੰ ਰਾਤ ਸੌਣ ਤੋਂ ਪਹਿਲਾਂ ਦੁੱਧ ਦੇ ਵਿੱਚ ਪੰਦਰ੍ਹਾਂ ਬੂੰਦਾਂ ਪਾ ਕੇ ਪੀਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਪੈਰਾਂ ਭਾਰ ਬੈਠ ਕੇ ਪੰਦਰ੍ਹਾਂ ਮਿਨਟ ਤੁਰਨਾ ਚਾਹੀਦਾ ਹੈ ਇਸ ਦੇ ਨਾਲ ਕੀ ਹੁੰਦਾ ਹੈ ਕਬਜ਼ ਦੀ ਬਿਮਾਰੀ ਤੋਂ ਪੰਦਰ੍ਹਾਂ ਦਿਨਾਂ ਦੇ ਵਿੱਚ ਵਿੱਚ ਅਰਾਮ ਮਿਲ ਜਾਂਦਾ ਹੈ ਇਹ ਨੁਸਖੇ ਪੁਰਾਣੇ ਜ਼ਮਾਨੇ ਵਿੱਚ ਬਹੁਤ ਪ੍ਰਸਿੱਧ ਹੁੰਦੇ ਸਨ ਪਰ ਅੱਜ ਕੱਲ੍ਹ ਲੋਕ ਸਿਰਫ਼ ਦਵਾਈਆਂ ਦੇ ਉੱਤੇ ਨਿਰਭਰ ਹੋ ਗਏ ਹਨ ਅਤੇ ਇਹਨਾਂ ਨੁਸਖਿਆਂ ਨੂੰ ਭੁੱਲੀ ਜਾ ਰਹੇ ਹਨ ਧੰਨਵਾਦ